ਚਿੱਤਰਕਾਰੀ ਸ਼ੁਰੂ ਕੀਤੇ ਮੈਨੂੰ ਹਾਲੇ ਦੋ ਹੀ ਸਾਲ ਹੋਏ ਹਨ ਮੇਰੀ ਚਿੱਤਰਕਾਰੀ ਵਿੱਚ ਦਿਲਚਸਪੀ ਮੈਨੂੰ ਆਪਣੀ ਪਤਨੀ ਦੀ ਚਿੱਤਰਕਾਰੀ ਦੇਖ ਕੇ ਹੋਈ ਉਸਨੇ ਬਹੁਤ ਸ ਸੋਹਣੀਆਂ ਸੋਹਣੀਆਂ ਚਿੱਤਰਕਾਰੀਆਂ ਕੀਤੀਆਂ ਹਨ ਉਹ ਆਪਣੀਆਂ ਕਲਪਨਾ ਨੂੰ ਕਿੱਦਾਂ ਚਿੱਤਰਕਾਰੀ ਦਾ ਰੂਪ ਦਿੰਦੀ ਹੈ ਇਹ ਦੇਖ ਕੇ ਮੈਨੂੰ ਬਹੁਤ ਆਨੰਦ ਆਉਂਦਾ ਹੈ ਮੈਂ ਕਈ ਵਾਰ ਸੋਚਦਾ ਹਾਂ ਉਹ ਕਿਸ ਤਰ੍ਹਾਂ ਆਪਣੇ ਖਿਆਲਾਂ ਨੂੰ ਆਪਣੀ ਕਲਪਨਾ ਨੂੰ ਇਸ ਚਿੱਤਰਕਾਰੀ ਵਿੱਚ ਪੇਸ਼ ਕਰ ਦਿੰਦੀ ਹੈ ਜਿਸ ਵਿੱਚ ਕਈ ਵਾਰ ਤਾਂ ਮੈਂ ਉਸਦੇ ਦਿਲ ਦੀਆਂ ਗੱਲਾਂ ਵੀ ਜਾਣ ਲੈਂਦਾ ਹਾਂ ਮੇਰਾ ਮਨ ਪਸੰਦ ਕਲਾਕਾਰ ਕੋਈ ਹੋਰ ਨਹੀਂ ਮੇਰਾ ਜੀਵਨ ਸਾਥੀ ਹੈ ਜਿਸ ਦੀ ਕਲਾ ਦਾ ਮੈਂ ਮੁਰੀਦ ਹੋ ਚੁੱਕਾ ਹਾਂ ਮੈਂ ਕਈ ਵਾਰ ਉਸ ਨੂੰ ਦੇਖਿਆ ਹੈ ਕਿ ਉਹ ਕਈ ਘੰਟੇ ਇਸ ਚਿੱਤਰਕਾਰੀ ਦੇ ਵਿੱਚ ਬਿਤਾ ਦਿੰਦੀ ਹੈ ਇਹ ਉਸਦੀ ਹੋਬੀ ਹੀ ਨਹੀਂ

ਉਸਦੀ ਕਲਪਨਾ ਦੇ ਮਾਧਿਅਮ ਰਾਹੀਂ ਉਸਦੇ ਜੀਵਨ ਦਾ ਇੱਕ ਬਹੁਤ ਹੀ ਵਧੀਆ ਆਧਾਰ ਬਣ ਰਿਹਾ ਹੈ ਮੈਂ ਕਈ ਵਾਰੀ ਦੇਖਿਆ ਹੈ ਕਿ ਉਸਨੇ ਕਈ ਮੁਸ਼ਕਿਲ ਤੋਂ ਮੁਸ਼ਕਿਲ ਚੀਜ਼ਾਂ ਨੂੰ ਬੜੀ ਆਸਾਨੀ ਨਾਲ ਚਿੱਤਰਕਾਰੀ ਦੇ ਰੂਪ ਵਿੱਚ ਪੇਸ਼ ਕੀਤਾ ਹੈ ਪਿਛਲੇ ਦਿਨਾਂ ਵਿੱਚ ਮੇਰੇ ਦੋਸਤਾਂ ਨੇ ਉਸਦੀ ਚਿੱਤਰਕਾਰੀ ਦਾ ਬਹੁਤ ਹੀ ਪ੍ਰਸ਼ੰਸਾ ਕੀਤੀ ਹੈ ਅਤੇ ਬਹੁਤ ਹੀ ਉਸਨੂੰ ਤਾਰੀਫ ਕੀਤੀ ਹੈ ਧੰਨਵਾਦ